ਮੈਨੂੰ ਔਨਲਾਈਨ ਸ਼ੌਪਿੰਗ ਦਾ ਬੜਾ ਸ਼ੌਕ ਹੈ ਇਸ ਲਈ ਮੈਂ ਆਪਣੇ ਫੋਨ 'ਚ ਫਲਿਪਕਾਰਟ ਐਪ ਡਾਊਨਲੋਡ ਕਰਕੇ ਰੱਖਿਆ ਹੈ ਜਿਹਦੇ ਵਿੱਚ ਮੈਂ ਇੱਕ ਦਿਨ ਖੋਲ੍ਹ ਕੇ ਬੈਠਾ ਸੀਗਾ ਮੈਨੂੰ ਉਹਦੇ ਵਿੱਚ ਇੱਕ ਬਹੁਤ ਸੋਹਣਾ ਸਪੀਕਰ ਦਿਖਿਆ ਫਿਰ ਮੈਂ ਉਹਨੂੰ ਦੋ ਤਿੰਨ ਦਿਨ ਤਾਂ ਪਹਿਲਾਂ ਦੇਖੀ ਗਿਆ ਬਹੁਤ ਬਹੁਤ ਵਧੀਆ ਲੱਗਦਾ ਸੀਗਾ ਫਿਰ ਜਦ ਮੇਰੇ ਕੋਲ ਪੈਸੇ ਹੋ ਗਏ ਫਿਰ ਮੈਂ ਉਹਨੂੰ ਔਡਰ ਕਰਤਾ ਫਿਰ ਮੈਂ ਉਹਨੂੰ ਚਲਾ ਕੇ ਜਾ ਕੇ ਦੇਖਿਆ ਜਦ ਮੇਰਾ ਔਡਰ ਆ ਗਿਆ ਫਿਰ ਮੈਂ ਉਹਨੂੰ ਚਲਾਇਆ ਤਾਂ ਉਹਦਾ ਆਵਾਜ਼ ਦੀ ਕੁਆਲਿਟੀ ਬਹੁਤ ਘੈਂਟ ਸੀਗੀ ਉਹ 'ਚ ਲਾਇਟਾਂ ਸੀਗੀਆਂ ਰੰਗ ਬਿਰੰਗਾ ਲਾਇਟਾਂ ਚਲਦੀ ਸੀਗੀਆਂ ਉਹਦੇ ਵਿੱਚ ਅਤੇ ਉਹਦੇ ਜਿਹੜੇ ਸਪੀਕਰ ਹੈ ਬਹੁਤ ਸੋਹਣਾ ਸੀਗਾ ਉਹਦੇ ਜਿਹੜੇ ਡਿਜ਼ਾਇਨ ਵੀ ਬਹੁਤ ਸੋਹਣਾ ਤਾ ਅਤੇ ਉਹਦੇ ਜਿਹੜੇ ਆਵਾਜ਼ ਹੈ ਉਹ ਬਹੁਤ ਸੋਹਣਾ ਲੱਗਦਾ ਤਾ ਸਪੀਕਰ ਦੀ ਕੁਆਲਿਟੀ ਸੀਗੀ ਅਤੇ ਮੈਂ ਸਾਰਾ ਦਿਨ ਉਹਨੂੰ ਆਪਣੇ ਕੋਲ ਰੱਖਦਾ ਹੁਣ ਇਹਨੂੰ ਡੇਲੀ ਮੈਂ ਆਪਣੇ ਕੋਲ ਨਾਲ ਚਲਾਉਂਦਾ ਰਹਿੰਦਾ